ਤਕਨੀਕੀ ਨਵੀਨਤਾਵਾਂ ਨੂੰ ਧਾਰਮਿਕ ਅਭਿਆਸਾਂ ਅਤੇ ਸੱਭਿਆਚਾਰਾਂ ਵਿੱਚ ਸ਼ਾਮਲ ਕੀਤਾ ਗਿਆ ਹੈ ਧਾਰਮਿਕ ਅਭਿਆਸਾਂ ਜਿਵੇਂ ਧਾਰਮਿਕ ਗ੍ਰੰਥਾਂ ਵਿੱਚ ਸੁਧਾਰ ਕੀਤਾ ਗਿਆ ਹੈ ਭਾਵ ਹੱਥ ਲਿਖਤ ਗ੍ਰੰਥਾਂ ਨੂੰ ਕੰਪਿਊਟਰਾਈਜ਼ ਕੀਤਾ ਗਿਆ ਹੈ ਭਾਵ ਉਹਨਾਂ ਨੂੰ ਪੜ੍ਹਨਾ ਹੁਣ ਸਭ ਲਈ ਸੌਖਾ ਕਰ ਦਿੱਤਾ ਗਿਆ ਹੈ ਅਤੇ ਸੱਭਿਆਚਾਰ ਵਿੱਚ ਵੀ ਸ਼ਾਮਲ ਕੀਤੀ ਆ ਗਿਆ ਹੈ ਜਿਵੇਂ ਨਵੇਂ ਨਾਚ ਪੇਸ਼ ਕੀਤੇ ਜਾਂਦੇ ਹਨ ਜਾਂ ਨਵੇਂ ਪਹਿਰਾਵੇ ਜੋ ਕਿ ਹਰ ਇਨਸਾਨ ਆਪਣੀ ਮਨਚਾਹੇ ਪਹਿਰਾਵੇ ਪਾ ਸਕਦਾ ਹੈ ਇਸ ਤਰ੍ਹਾਂ ਤਕਨੀਕੀ ਨਵੀਨਤਾਵਾਂ ਨੇ ਇਹਨਾਂ ਚੀਜ਼ਾਂ ਵਿੱਚ ਸੁਧਾਰ ਕੀਤਾ ਹੈ